ਦਲਜਿੰਦਰ ਸਿੰਘ ਜੀ ਦੀ ਗੱਲ ਕਰ ਰਹੇ ਹੋ ਹਾਂ ਸਰ ਮੈਂ ਜਗਬਾਣੀ ਅਖ਼ਬਾਰ ਤੋਂ ਗੁਰਦੀਪ ਸਿੰਘ ਗੱਲ ਕਰ ਰਿਹਾ ਹਾਂਜੀ ਹਾਂਜੀ ਸਰ ਫਰੀ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਸਰ ਇੱਦਾਂ ਨਾ ਜੀ ਜੇ ਆਪਾਂ ਪਹਿਲਾਂ ਪੁੱਛ ਲੈਣਾ ਚੰਗਾ ਹੁੰਦਾ ਬੰਦਾ ਜੀ ਫਰੀ ਹੋਵੇ ਤੇ ਤਾਂ ਹੀ ਗੱਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਨਾ ਤੁਹਾਡੇ ਤੋਂ ਜੀ ਅੱਜ ਹਾਂਜੀ ਇੱਕ ਤੁਹਾਡੇ ਤੋਂ ਨਾ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈਣੀ ਆ ਆਪਾਂ ਨਾ ਇੱਕ ਆਪਣੇ ਅਖ਼ਬਾਰ 'ਤੇ ਸਿੱਖ ਇਤਿਹਾਸ ਬਾਰੇ ਕੋਈ ਇੱਕ ਇਹੋ ਜਿਹਾ ਵੀ ਹੈ ਵਧੀਆ ਹਿੰਟ ਲਿਖਣਾ ਜੀ ਜਿੱਦਾਂ ਦੇ ਮੰਨ ਕੇ ਚੱਲੋ ਵੀ ਆਪਣੇ ਵੀ ਮੁਕਤਸਰ ਦਾ ਨਾਮ ਵੀ ਮੁਕਤ ਮੁਕਤਸਰ ਕਿਵੇਂ ਪਿਆ ਵੀ ਪਹਿਲਾਂ ਕੀ ਸੀਗਾ ਵੀ ਇੱਥੇ ਵੀ ਕਿਹੜੇ ਗੁਰੂ ਆਏ ਸੀਗੇ ਵੀ ਉਹਨਾਂ ਨੇ ਵੀ ਇਤਿਹਾਸ ਰਚਿਆ ਸੀਗਾ ਅਤੇ ਉਹ ਸਾਰਾ ਕੁਝ ਮੈਨੂੰ ਦੱਸੋ ਹਾਂਜੀ ਹਾਂਜੀ ਅੱਛਾ ਖਿਦਰਾਣੇ ਦੀ ਢਾਬ ਹਾਂਜੀ ਹਾਜੀ ਅੱਛਾ ਜੀ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਅੱਛਾ ਜੀ ਅੱਛਾ ਜੰਗ ਹੋਈ ਹਾਂਜੀ ਹਾਂਜੀ ਅੱਛਾ ਜੀ

ਅੱਛਾ ਜੀ ਹਾਂਜੀ ਹਾਂਜੀ

ਅੱਛਾ ਜੀ ਹਾਂਜੀ ਹਾਂਜੀ ਅੱਛਾ ਸਰ ਆਪਣਾ ਆਪਣਾ ਹਾਂਜੀ ਹਾਂਜੀ ਸਰ ਇਹ ਜਾਣਕਾਰੀ ਚਲੋ ਦੇਣ ਲਈ ਧੰਨਵਾਦ ਤੁਹਾਡਾ ਸ਼ੁਭ ਨਾਮ ਦਿਲਜਿੰਦਰ ਸਿੰਘ ਹੀ ਹੈ ਨਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇਦਾਂ ਨਾ ਤਾਂ ਨਾਮ ਪੁੱਛ ਰਹੇ ਹਾਂ ਵੀ ਥੱਲੇ ਵੀ ਤੁਹਾਡੇ ਨਾਮ ਦੇ ਪਿੱਛੇ ਵੀ ਇਹ ਵੀ ਇਸ ਪਰਸਨ ਤੋਂ ਅਸੀਂ ਜਾਣਕਾਰੀ ਸ਼ੇਅਰ ਕੀਤੀ ਸੀ ਇਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਜੀ ਹਾਂਜੀ ਜੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਾਨੂੰ ਜਾਣਕਾਰੀ ਸਾਂਝੀ ਕੀਤੀ ਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਸਰ ਫਿਰ ਓਕ ਓਕੇ ਓਕੇ ਸਰ